ਨੌਕਰੀ ਅਤੇ ਆਪਣੇ ਕੰਮ ਵਿੱਚੋਂ ਕਿਹੜਾ ਚੰਗਾ ਹੈ ਮੇਰੇ ਹਿਸਾਬ ਨਾਲ਼ ਜੇ ਕੋਈ ਬੰਦਾ ਆਪਣਾ ਕੰਮ ਕਰਦਾ ਹੈ ਉਹ ਜ਼ਿਆਦਾ ਵਧੀਆ ਬਜਾਏ ਕਿ ਨੌਕਰੀ ਤੋਂ ਨੌਕਰੀ ਬੰਦਾ ਕਰਦਾ ਨੌ ਤੋਂ ਲੈ ਕੇ ਜਿਵੇਂ ਪੰਜ ਵਜੇ ਤੱਕ ਕਰਦਾ ਤਾਂ ਉਨਾਂ ਕੁ ਸਮਾਂ ਹੀ ਆਪਣੇ ਉਸ ਕੰਮ ਨੂੰ ਦਿੰਦਾ ਹੈ ਪਰ ਜਿਹੜਾ ਕੋਈ ਬੰਦਾ ਆਪਣਾ ਕੰਮ ਕਰਦਾ ਉਹਦੇ ਦਿਮਾਗ਼ 'ਚ ਸਾਰਾ ਦਿਨ ਹੀ ਚੱਲੀ ਜਾਂਦਾ ਕਿ ਮੈਂ ਇਹਨੂੰ ਕੰਮ ਨੂੰ ਕਿਵੇਂ ਹੋਰ ਵਧਾਵਾਂ ਕਿੱਥੋਂ ਹੋਰ ਗਾਹਕ ਨਵੇਂ ਲੈ ਕੇ ਆਵਾਂ ਜਾਂ ਕਿਹੜੀ ਚੀਜ਼ ਕਿੱਥੇ ਹੋਰ ਐਡ ਕੀਤੀ ਜਾ ਸਕਦੀ ਹੈ ਇਹਦੇ ਵਿੱਚ ਕਿ ਮੇਰਾ ਮੁਨਾਫ਼ਾ ਵਧੇ ਬਟ ਜਿਹੜਾ ਬੰਦਾ ਨੌ ਤੋਂ ਪੰਜ ਕੰਮ ਕਰਦਾ ਸਿਰਫ਼ ਉਹ ਆਪਣਾ ਜਿਹੜਾ ਕੰਮ ਉਹਨੂੰ ਦਿੱਤਾ ਜਾਂਦਾ ਉਹੀ ਕਰਦਾ ਉਹ ਇਹ ਨਹੀਂ ਸੋਚਦਾ ਕੋਈ ਮੈਂ ਐਕਸਟਰਾ ਕਰ ਸਕਦਾ ਕਿ ਨਹੀਂ ਕਰ ਸਕਦਾ ਉਹ ਕਹਿੰਦਾ ਮੈਂ ਨੌ ਤੋਂ ਪੰਜ ਕੰਮ ਕਰ ਲਿਆ ਹੁਣ ਮੈਂ ਵਿਹਲਾ ਸ਼ਾਮ ਨੂੰ ਅਤੇ ਮੈਂ ਹੁਣ ਟੀਵੀ ਦੇਖੂਗਾ ਮੈਂ ਕੁਝ ਹੋਰ ਕਰੂ ਮੈਂ ਘੁੰਮਣ ਜਾਊਂਗਾ ਜਾਣੀ ਜੇ ਕੋਈ ਛੁੱਟੀ ਹੁੰਦੀ ਹੈ ਜਿਵੇਂ ਐਤਵਾਰ ਨੂੰ ਜਾਂ ਸ਼ਨੀਵਾਰ ਨੂੰ ਉਹ ਵੀ ਟਾਈਮ ਉਹ ਘੁੰਮ ਕੇ ਜਾਂ ਹੋਰ ਕਿਤੇ ਜਾ ਕੇ ਮਿੱਤਰਾਂ ਨੂੰ ਮਿਲ ਕੇ ਆਪਣਾ ਖ਼ਰਾਬ ਕਰ ਲੈਂਦਾ ਪਰ ਜਿਹੜਾ ਕੋਈ ਬੰਦਾ ਆਪਣਾ ਕੰਮ ਕਰਦਾ ਉਹ ਛੁੱਟੀ ਵਾਲੇ ਦਿਨ ਨੂੰ ਵੀ ਕਹਿੰਦਾ ਕਿ ਮੈਂ ਇਹ ਵੀ ਲਾਹਾ ਲੈ ਲਾਂ ਕਿ ਇਹਦੇ ਵਿੱਚੋਂ ਵੀ ਮੈਂ ਕੋਈ ਪੈਸੇ ਕਮਾ ਲਾਂ ਟਾਈਮ ਆਪਣਾ ਲਾ ਕੇ ਆਪਣੇ ਕੰਮ ਦੇ ਵਿੱਚ ਅਤੇ ਜੋ ਜਿਹੜਾ ਬੰਦਾ ਆਪਣਾ ਕੰਮ ਕਰਦਾ ਹੈ ਉਹ ਮਾਰਕਿਟ ਦੇ ਵਿੱਚ ਹਮੇਸ਼ਾਂ ਜਿਵੇਂ ਕਹਿ ਲਉ ਕਿ ਰਹਿੰਦਾ ਅਤੇ ਉਹਨੂੰ ਨਵੇਂ ਨਵੇਂ ਕੰਮਾਂ ਦਾ ਹੋਰ ਪਤਾ ਲੱਗਦਾ ਉਹ ਆਪਣੇ ਕੰਮ ਨੂੰ ਛੱਡ ਕੇ ਕੋਈ ਨਵੇਂ ਕੰਮ ਵੀ ਹੋਰ ਸ਼ੁਰੂ ਕਰਦਾ ਅਤੇ ਇਹਦੇ ਨਾਲ਼ ਕੀ ਆ ਉਹ ਆਪਣਾ ਮੁਨਾਫ਼ਾ ਹੋਰ ਵਧਾ ਲੈਂਦਾ ਅਤੇ ਅੱਗੇ ਜਿਹੜੇ ਉਹਦੇ ਜਿਹੜੇ ਬੱਚੇ ਨੇ ਹੈ ਨਾ ਉਹ ਵੀ ਉਹਨਾਂ ਨੂੰ ਕੋਈ ਕੰਮ ਲੱਭਣ ਦੀ ਲੋੜ ਨਹੀਂ ਹੈਗੀ ਜਿਵੇਂ ਆਪਾਂ ਕਹਿੰਦੇ ਕਿ ਪ ਪਹਿਲਾਂ ਪੜ੍ਹ ਲਓ ਪੜ੍ਹ ਕੇ ਫਿਰ ਨੌਕਰੀ ਲੱਭੋ ਅਤੇ ਇਹ ਵਾਲਾ ਕੰਮ ਨਹੀਂ ਕਰਨਾ ਪੈਂਦਾ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਬਣੀ ਬਣਾਈ ਇੱਕ ਚੀਜ਼ ਮਿਲ ਜਾਂਦੀ ਹੈ ਅਤੇ ਬੰਦਾ ਆਪਣਾ ਕੰਮ ਆਪਣੇ ਅੱਗੇ ਬੱਚਿਆਂ ਨੂੰ ਵੀ ਸੌਂਪ ਦਿੰਦਾ ਅਤੇ ਉਹ ਉਸ ਤਰ੍ਹਾਂ ਅੱਗੇ ਉਹਨੂੰ ਵਧਾਈ ਤੁਰੀ ਜਾਂਦੇ ਨੇ